ਸਫਰਿੰਗ ਸਾਡੇ ਮਾਨਸਿਕ ਅਤੇ ਸਰੀਰਿਕ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵ ਕਰਦੀ ਆ ਕਰੇਗੀ ਵੀ ਅੱਗੇ ਕਰਦੇ ਵੀ ਰਹੇਗੀ ਕਿਉਂਕਿ ਜਦੋਂ ਸਾਰਾ ਦਿਨ ਅਸੀਂ ਕ ਫੋਨ ਦੇ ਵਿੱਚ ਟੈਬਲੇਟ ਦੇ ਵਿੱਚ ਕੰਪਿਊਟਰ ਦੇ ਨਾਲ ਘਿਰੇ ਹੋਏ ਹਾਂ ਯੁੱਗ ਹੀ ਕਹਿੰਦੇ ਕਿ ਵੀ ਸਾਇੰਸ ਦਾ ਵਾ ਕੰਪਿਊਟਰਾਂ ਦਾ ਵਾ ਜਦੋਂ ਅਸੀਂ ਇਹਨਾਂ ਦੇ ਆਲੇ ਦੁਆਲੇ ਚੌਵੀ ਘੰਟੇ ਅਸੀਂ ਇਹਨਾਂ ਦੇ ਆਲੇ ਦੁਆਲੇ ਘਿਰੇ ਹੋਏ ਹਾਂ ਤਾਂ ਸਾਨੂੰ ਮਾਨਸਿਕ ਤੌਰ 'ਤੇ ਵੀ ਇਹ ਬਿਮਾਰ ਕਰ ਰਹੀ ਆ ਅਤੇ ਸਰੀਰਕ ਤੌਰ 'ਤੇ ਵੀ ਇਹ ਬਹੁਤ ਜ਼ਿਆਦਾ ਬਿਮਾਰ ਕਰ ਰਹੀ ਹੈ ਇੱਕ ਹਿਸਾਬ ਦਾ ਇਹ ਬਿਮਾਰੀ ਇਹ ਕਾਰਨ ਆ ਵੀ ਅ ਸਾਡੇ ਬਿਮਾਰ ਹੋਣ ਦਾ ਕਿੱਥੇ ਪਹਿਲਾਂ ਇੱਕ ਟਾਈਮ ਸੀਗਾ ਕਿ ਬੱਚੇ ਜਾਂ ਦੁਨੀਆਂ ਅ ਔਰਤਾਂ ਜਾਂ ਮਰਦ ਸਾਰੇ ਕੀ ਆ ਰੋਟੀ ਖਾਣ ਤੋਂ ਬਾਅਦ ਬਾਹਰ ਘੁੰਮਣ ਜਾਂਦੇ ਦਸ ਅ ਆਪਣੇ ਘਰਦਿਆਂ ਨਾਲ ਬਹਿੰਦੇ ਆਪਣੇ ਮਾਂ ਪਿਓ ਨਾਲ ਬੱਚਿਆਂ ਨਾਲ ਘਰਵਾਲੀ ਨਾਲ ਸਾਰਿਆਂ ਨਾਲ ਬੈਠਦੇ ਹੁਣ ਕੀ ਆ ਉਹ ਜਿਹੜਾ ਟਾਈਮ ਆ ਉਹ ਸਰਫ ਸਰਫਿੰਗ ਨੇ ਲੈ ਲਿਆ ਕੰਪਿਊਟਰ ਨੇ ਲੈ ਲਿਆ ਫੂਨ ਨੇ ਲੈ ਲਿਆ ਨਾ ਕੰਮ ਹੁੰਦਿਆਂ ਹੋਇਆਂ ਵੀ ਸਾਨੂੰ ਫੋਨ 'ਤੇ ਅਸੀਂ ਕੀ ਆ ਕਿ ਦੂਜਿਆਂ ਦੀਆਂ ਰੀਲਾਂ ਵਾਸਤੇ ਟਾਈਮ ਕੱਢਦੇ ਹਾਂ ਉਹਨਾਂ ਦੀਆਂ ਰੀਲਾਂ ਵੇਖਦੇ ਇੱਕ ਮਿੰਟ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਘੱਟੋ ਘੱਟ ਤੀਹ ਜਾਂ ਪੈਂਤੀ ਤੱਕ ਰੀਲਾਂ ਅਸੀਂ ਰੀਲਸ ਵੇਖ ਲੈਂਦੇ ਹਾਂ ਲੋਕਾਂ ਦੀਆਂ ਉਹ ਹੀ ਟਾਈਮ ਆ ਜੀ ਅਗਰ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਮਾਤਾ ਪਿਤਾ ਨਾਲ ਘਰ ਵਾਲੀ ਨਾਲ ਆਪਣੇ ਗੱਲਾਂ ਬਾਤਾਂ ਦੇ ਵਿੱਚ ਆਪਣੇ ਦੁੱਖ ਸਾਂਝੇ ਕਰਨ ਦੇ ਵਿੱਚ ਲਗਾਇਆ ਹੋਵੇ ਤਾਂ ਅਸੀਂ ਨਾ ਮਾਨਸਿਕ ਤੌਰ 'ਤੇ ਬਿਮਾਰ ਹੋਈਏ ਨਾ ਸਰੀਰਿਕ ਤੌਰ 'ਤੇ ਬਿਮਾਰ ਹੋਈਏ ਸਰੀਰਿਕ ਤੌਰ 'ਤੇ ਤਾਂ ਇਸ ਕਰਕੇ ਅਸੀਂ ਬਿਮਾਰ ਹਾਂ ਕਿਉਂਕਿ ਰੋਟੀ ਖਾਣ ਵੇਲੇ ਵੀ ਸਾਨੂੰ ਚਾਹ ਪੀਣ ਵੇਲੇ ਵੀ ਪਾਣੀ ਪੀਣ ਵੇਲੇ ਵੀ ਕੀ ਆ ਫੂਨ ਚਾਹੀਦਾ ਹੁੰਦਾ ਮੈਂ ਬਹੁਤ ਘਰਾਂ ਦੇ ਵਿੱਚ ਦੇਖਿਆ ਵੀ ਆਪ ਸ ਸੁਣਿਆ ਵੀ ਆ ਕਿ ਬੱਚਾ ਕੇ ਬੱਚੇ ਜ਼ਿਦ ਕਰਦੇ ਨੇ ਕਿ ਅਸੀਂ ਰੋਟੀ ਤਾਂ ਖਾਵਾਂਗੇ ਆਹ ਚੀਜ਼ ਤਾਂ ਖਾਵਾਂਗੇ ਆਹ ਚੀਜ਼ ਤਾਂ ਪੀਵਾਂਗੇ ਜੇ ਤੁਸੀਂ ਸਾਨੂੰ ਫੂਨ ਦਓਂਗੇ ਤਾਂ ਦਵਾਂਗੇ ਅਤੇ ਮਾਂ ਪਿਓ ਉਹਨਾਂ ਨੂੰ ਰੋਟੀ ਖਵਾਉਣ ਖਾਤਿਰ ਕੀ ਆ ਕਿ ਫੂਨ ਦੇ ਦਿੰਦੇ ਆ ਪਰ ਇਹ ਨਹੀਂ ਦੇਖਦੇ ਕਿ ਉਹਨਾਂ ਦਾ ਅੱਖਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਦੇ ਦਿਮਾਗ ਦਾ ਨੁਕਸਾਨ ਹੋ ਰਿਹਾ ਉਹਨਾਂ ਦੇ ਸਰੀਰ ਦਾ ਨੁਕਸਾਨ ਹੋ ਰਿਹਾ ਬੈਠਿਆਂ ਬੈਠਿਆਂ ਬੱਚਾ ਕਿੰਨੀ ਕਿੰਨੀ ਦੇਰ ਤੱਕ ਬੈਠਾ ਬੈਠਾ ਬੈਡ 'ਤੇ ਫੂਨ ਚਲਾਉਂਦਾ ਵਾ ਇਹ ਨਹੀਂ ਉਹਨਾਂ ਨੂੰ ਪਤਾ ਲੱਗਦਾ ਕਿੱਥੇ ਬੱਚਾ ਬਾਹਰ ਖੇਡੇਗਾ ਸਾਈਕਲ ਚਲਾਏਗਾ ਕ੍ਰਿਕਟ ਖੇਡੇਗਾ ਫੁਟਬਾਲ ਖੇਡੇਗਾ ਉਹਦੇ ਨਾਲ ਉਹਦੀ ਸਿਹਤ ਬਣੇਗੀ ਅਤੇ ਸਰੀਰ ਬਣੇਗਾ ਮਾਨਸਿਕ ਤੌਰ 'ਤੇ ਉਹ ਬੱਚਾ ਬਿਮਾਰ ਹੋ ਰਿਹਾ ਕਿਉਂ ਉਹਨੂੰ ਉਹ ਇਹ ਚੀਜ਼ ਦੀ ਨਸ਼ਾ ਹੋ ਗਿਆ ਉਹਨੂੰ ਕੁਛ ਨਹੀਂ ਆ ਸਕੂਲ ਤੋਂ ਆਉਂਦਿਆਂ ਨੂੰ ਫੂਨ ਚਾਹੀਦਾ ਸਕੂਲ ਤੋਂ ਆਉਂਦਿਆਂ ਨੂੰ ਟੀ ਵੀ ਚਾਹੀਦਾ ਆਹ ਚੀਜ਼ਾਂ ਚਾਹੀਦੀਆਂ ਇਹ ਕੀ ਆ ਕਿ ਉਹਨੂੰ ਮਾਨਸਿਕ ਤੌਰ 'ਤੇ ਖਰਾਬ ਕਰ ਰਿਹਾ ਨਾ ਤਾਂ ਬੱਚੇ ਦਾ ਪੜ੍ਹਾਈ 'ਚ ਧਿਆਨ ਆ ਨਾ ਬੱਚੇ ਦਾ ਕਿਸੇ ਖੇਡਾਂ ਵੱਲ ਧਿਆਨ ਆ ਨਾ ਬੱਚੇ ਦਾ ਕਿਸੇ ਬੱਚੇ ਗੱਲਾਂ ਕਰਨ 'ਚ ਧਿਆਨ ਨਾ ਆਪਣੇ ਮਾਤਾ ਪਿਤਾ ਨਾਲ ਕੋਈ ਗੱਲਬਾਤ ਕਰਦਾ ਸਕੂਲ ਦੀ ਨਾ ਕੋਈ ਦੱਸਦਾ ਨਾ ਆਪਣੇ ਟੀਚਰ 'ਚ ਉਹਦਾ ਧਿਆਨ ਆ ਕਿਉਂ ਕਿਉਂਕਿ ਉਹਦਾ ਜਿਹੜਾ ਖਿੱਚ ਦਾ ਕੇਂਦਰ ਆ ਸਾਰਾ ਸਾਰੀ ਖਿੱਚ ਦਾ ਕੇਂਦਰ ਆ ਉਹ ਸਰਫਿੰਗ ਬਣਿਆ ਹੋਇਆ ਫੂਨ ਬਣਿਆ ਹੋਇਆ ਫੂਨ ਬਿਨ੍ਹਾਂ ਸਾਰੇ ਕਹਿੰਦੇ ਅਸ ਲੋਕ ਆ ਕਿ ਜਿਹੜੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਹੋਰ ਕੁਛ ਨਹੀਂ ਦੇਖਦੇ ਕਿ ਅਸੀਂ ਕੁਛ ਲਿਆ ਕੇ ਨਾ ਲਿਆ ਜ਼ਰੂਰੀ ਕਾਗਜ਼ਾਤ ਲਏ ਜ਼ਰੂਰੀ ਪੱਤਰ ਲਏ ਨਹੀਂ ਉਹਨਾਂ ਨੂੰ ਇਹ ਚਾਹੀਦਾ ਕਿ ਸਾਡਾ ਫੂਨ ਸਾਡੇ ਕੋਲ ਹੋਣਾ ਚਾਹੀਦਾ ਕੋਈ ਇੱਕ ਮਿੰਟ ਵੀ ਵਿਹਲਾ ਹੋ ਜੇ ਨਾ ਕੁਛ ਨਹੀਂ ਆ ਚੱਕ ਕੇ ਰੀਲਾਂ ਖੋਲ੍ਹਣ ਲੱਗ ਪੈਂਦਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਨੇ ਦੁਨੀਆਂ ਤੱਕ ਸਾਰਿਆਂ ਨੂੰ ਬਹੁਤ ਖਰਾਬ ਕੀਤਾ ਹੋਇਆ ਫੇਸਬੁੱਕ ਨੇ ਇੰਸਟਾਗ੍ਰਾਮ ਨੇ ਟਵੀਟਰ ਨੇ ਕੀ ਆ ਮਾੜੀ ਜਿਹੀ ਵੀ ਕੋਈ ਆਪਣੀ ਪਰਸਨਲ ਲਾਈਫ ਹੁੰਦੀ ਆ ਉਹ ਵੀ ਉਹ ਸਰਫਿੰਗ 'ਤੇ ਕੰਪਿਊਟਰ 'ਤੇ ਲੈਪਟੋਪ 'ਤੇ ਆਪਣੇ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਆ ਸਾ ਇਸ ਕਰਕੇ ਸਰਫਿਕਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰ ਰਹੀ ਆ ਸਾਨੂੰ